ਪਿਛਲੇ ਕਈ ਸਾਲਾਂ ਤੋਂ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਜ਼ਿਆਦਾ ਬਦਲਾਵ ਆਇਆ ਹੈ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਸਮੇਂ ਸਮੇਂ ਸਮੇਂ 'ਤੇ ਹਰੇਕ ਚੀਜ਼ ਦੇ ਵਿੱਚ ਬਦਲਾਵ ਆਉਂਦਾ ਹੈ ਅਤੇ ਬਦਲਾਵ ਸਾਡੇ ਲਈ ਕਈ ਵਾਰ ਸਕਾਰਾਤਮਕ ਹੁੰਦਾ ਅਤੇ ਕਈ ਵਾਰ ਨਕਾਰਾਤਮਕ ਹੁੰਦਾ ਹੈ ਪਰ ਜਿਹੜਾ ਸਾਡੇ ਆਰਥਿਕ ਢਾਂਚੇ ਦੇ ਵਿੱਚ ਸਾਡੇ ਬੁਨਿਆਦੀ ਢਾਂਚੇ ਦੇ ਵਿੱਚ ਸਮਾਜਿਕ ਤਬਦੀਲੀ ਮਲ ਕਿ ਸਮਾਜਿਕ ਤਬਦੀਲੀਆਂ ਆਈਆਂ ਹਨ ਇਹ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਅਤੇ ਚੰਗੀਆਂ ਹਨ ਜਿਵੇਂ ਕਿ ਕਾਫ਼ੀ ਸਾਲਾਂ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਬਦਲਾਵ ਆਇਆ ਹੈ ਕਿੱਥੇ ਕਾਫ਼ੀ ਜ਼ਿਆਦਾ ਸ਼ੋਅਰੂਮ ਕਾਫ਼ੀ ਜ਼ਿਆਦਾ ਦੁਕਾਨਾਂ ਕਾਫ਼ੀ ਜ਼ਿਆਦਾ ਮੋਲ ਕਾਫ਼ੀ ਜ਼ਿਆਦਾ ਬਿਲਡਿੰਗਾਂ ਕਾਫ਼ੀ ਜ਼ਿਆਦਾ ਦਫ਼ਤਰ ਕਾਫ਼ੀ ਜ਼ਿਆਦਾ ਇੰਡਸਟਰੀ ਕੰਮ ਕਰਨ ਮਲ ਕਿ ਕੰਮ ਕਰਨ ਵਾਲੀ ਫੈਕਟਰੀਆਂ ਵਗੈਰਾ ਕਾਫ਼ੀਆਂ ਦਾ ਉਹ ਜੱਗ ਬਣੀਆਂ ਹਨ ਜੋ ਕਿ ਆਮ ਲੋਕਾਂ ਲਈ ਬਹੁਤ ਸੁਵਿਧਾਵਾਂ ਪ੍ਰਦਾਨ ਕਰਦੀਆਂ ਹਨ ਜਿਵੇਂ ਕਿ ਲੋਕ ਕਿਸੇ ਸਮਾਨ ਨੂੰ ਖਰੀਦਣ ਲਈ ਕਾਫ਼ੀ ਦੂਰ ਜਾਂਦੇ ਸੀ ਕਿਉਂਕਿ ਉਹਨਾਂ ਦੇ ਨੇੜੇ ਤੇੜੇ ਇਹ ਸਮਾਨ ਚੰਗੀ ਕੀਮਤ 'ਤੇ ਨਹੀਂ ਮਿਲਦਾ ਸੀ ਪਰ ਇਹਨਾਂ ਦੁਕਾਨਾਂ ਸ਼ੋਅਰੂਮਾਂ ਮੋਲਾਂ ਆਦਿ ਦੇ ਖੁੱਲ੍ਹਣ ਨਾਲ਼ ਇਹ ਚੀਜ਼ਾਂ ਲੋ ਲੋਕਾਂ ਨੂੰ ਆਸਾਨੀ ਨਾਲ਼ ਉਪਲਬਧ ਹੋਣ ਲੱਗ ਪਈਆਂ ਅਤੇ ਸਹੀ ਰੇਟ ਸਹੀ ਕੀਮਤ 'ਤੇ ਮਿਲਣ ਲੱਗ ਪਈਆਂ ਅਤੇ ਇਹਨਾਂ ਨੂੰ ਲੋਕਾਂ ਨੂੰ ਕਾਫ਼ੀ ਜ਼ਿਆਦਾ ਹੋਰ ਨਵੀਂ ਔਫਰ ਆਪਣੇ ਡਿਸਕਾਊਂਟ ਆਪਣੇ ਬਹੁਤ ਜ਼ਿਆਦਾ ਸੁਵਿਧਾਵਾਂ ਪ੍ਰਾਪਤ ਹੋਈਆਂ ਨੇ ਅਤੇ ਇੱਥੇ ਬਦਲਾਵ ਆਇਆ ਹੈ ਕਿ ਇੱਥੇ ਦਫ਼ਤਰ ਵਗੈਰਾ ਕ ਆਪਣਾ ਸਰਕਾਰੀ ਦਫ਼ਤਰ ਕਾਫ਼ੀ ਜ਼ਿਆਦਾ ਖੁੱਲ੍ਹੇ ਹਨ ਪੁਲਿਸ ਥਾਣਾ ਹੋ ਗਿਆ ਹੋਸਪੀਟਲ ਹੋ ਗਿਆ ਜਿਹਦੇ ਨਾਲ਼ ਇੱਕ ਤਾਂ ਲੋਕਾਂ ਨੂੰ ਇਹ ਸੁਵਿਧਾ ਪ੍ਰਾਪਤ ਹੋਈ ਕਿ ਜਿਹੜਾ ਲੋਕਾਂ ਦਾ ਕੰਮ ਸਰਕਾਰੀ ਕੰਮ ਚਾਰ ਪੰਜ ਦਿਨਾਂ ਦਾ ਹਫ਼ਤੇ ਤੱਕ ਜਾਂਦਾ ਸੀ ਜਾਂ ਮਹੀਨਿਆਂ ਤੱਕ ਜਾਂਦਾ ਸੀ ਉਹ ਕੰਮ ਹੁਣ ਇੱਕ ਦੋ ਦਿਨ ਦੇ ਵਿੱਚ ਜਲਦੀ ਤੋਂ ਜਲਦੀ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਜ਼ਿਆਦਾ ਦੇਰ ਕਿਸੇ ਲਾਈਨ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਬਹੁਤ ਆ ਲੋਕ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਇਸ ਗੱਲ ਦੀ ਸਿਫ਼ਤ ਕਰਦੇ ਹਨ ਕਿ ਕਾਫ਼ੀ ਜ਼ਿਆਦਾ ਸਰਕਾਰੀ ਦਫ਼ਤਰ ਖੁੱਲ੍ਹਣ ਨਾਲ਼ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ ਅਤੇ ਉਹਨਾਂ ਨੂੰ ਕਿਸੇ ਕੰਮ ਨੂੰ ਕਰਨ ਲਈ ਜ਼ਿਆਦਾ ਨਾ ਸਮਾਂ ਦੇਣ ਦੀ ਲੋੜ ਪੈਂਦੀ ਹੈ ਅਤੇ ਨਾ ਕਿਤੇ ਜ਼ਿਆਦਾ ਦੂਰ ਜਾਣ ਦੀ ਲੋੜ ਪੈਂਦੀ ਹੈ